ਭਾਰਤ ਵਿੱਚ ਸਾਨੂੰ ਇਹਨਾਂ ਕੁਝ ਥਾਵਾਂ 'ਤੇ ਜ਼ਰੂਰ ਜਾਣਾ ਚਾਹੀਦਾ ਹੈ ਏ ਜਿਵੇਂ ਇਤਿਹਾਸਕ ਸਥਾਨ ਸਮਾਜਿਕ ਸਥਾਨ ਅਤੇ ਧਾਰਮਿਕ ਸਥਾਨਾਂ 'ਤੇ ਤਾਂ ਜ਼ਰੂਰ ਜਾਣਾ ਚਾਹੀਦਾ ਹੈ ਜਿਵੇਂ ਕਿ ਸਾਡੇ ਧਾਰਮਿਕ ਸਥਾਨ ਪੰਜਾਬ ਵਿੱਚ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿੱਚ ਅੰਮ੍ਰਿਤਸਰ ਜ਼ਰੂਰ ਜਾਣਾ ਚਾਹੀਦਾ ਹੈ ਕਿਉਂਕਿ ਉੱਥੇ ਇਹ ਪਤਾ ਲੱਗਦਾ ਹੈ ਕਿ ਹਰਿਮੰਦਰ ਸਾਹਿਬ ਦੇ ਜੋ ਚਾਰ ਦਰਵਾਜ਼ੇ ਹਨ ਉਹ ਇਸ ਲਈ ਹਨ ਕਿਉਂਕਿ ਉੱਥੇ ਕਿਸੇ ਵੀ ਜਾਤ ਧਰਮ ਬਾਰੇ ਜਾਤ ਧਰਮ ਲਈ ਕੋਈ ਵੀ ਰੋਕ ਟੋਕ ਨਹੀਂ ਹੈ ਹਰੇਕ ਜਾਤ ਧਰਮ ਦਾ ਇਨਸਾਨ ਉੱਥੇ ਆ ਕੇ ਆਪ ਮੱਥਾ ਟੇਕ ਸਕਦਾ ਹੈ ਅਤੇ ਆਪਣੀ ਸ਼ਰਧਾ ਚੜ੍ਹਾ ਸਕਦਾ ਹੈ ਅਤੇ ਕੋਈ ਵੀ ਮਨ ਵਿੱਚ ਪਾਪ ਹੋਵੇ ਅਤੇ ਮੈਲ ਸਰੋਵਰ ਵਿੱਚ ਨਹਾ ਕੇ ਧੋ ਵੀ ਸਕਦਾ ਹੈ ਅਤੇ ਜਿਵੇਂ ਹੋਰ ਇਹ ਧਾਰਮਿਕ ਸਥਾਨ ਹਨ ਟੋਡਰ ਮੱਲ ਦੀ ਹਵੇਲੀ ਫਤਿਹਗੜ੍ਹ ਸਾਹਿਬ ਵਗੈਰਾ ਇਹ ਅਨੰਦਪੁਰ ਸਾਹਿਬ ਅਤੇ ਜਿੱਥੇ ਅਨੰਦਪੁਰ ਸਾਹਿਬ ਆਦਿ ਅਤੇ ਸਮਾਜਿਕ ਸਥਾਨ ਜਿਵੇਂ ਕਿ ਦਿੱਲੀ ਵਿੱਚ ਲਾਲ ਕਿਲਾ ਤਾਜ ਮਹਿਲ ਅਤੇ ਇਤਿਹਾਸ ਇਤਿਹਾਸਕ ਸਥਾਨ ਜਿਵੇਂ ਕਿ ਸਾਨੂੰ ਉੱਥੇ ਦਾ ਇਤਿਹਾਸ ਪਤਾ ਲੱਗਦਾ ਹੈ ਤਾਜ ਮਹਿਲ ਦਾ ਇਤਿਹਾਸ ਵੀ ਤਾਜ ਮਹਿਲ ਕਿਸ ਨੇ ਬਣਵਾਇਆ ਸੀ ਅਤੇ ਕਿਉਂ ਬਣਵਾਇਆ ਸੀ ਅਤੇ ਇਸ ਲਈ ਸਾਨੂੰ ਇਹਨਾਂ ਸਥਾਨਾਂ 'ਤੇ ਜ਼ਰੂਰ ਜਾਣਾ ਚਾਹੀਦਾ ਹੈ